ਸਾਡੇ ਖੇਤਰ ਦੇ ਵਿੱਚ ਬਹੁਤ ਸਾਰੀਆਂ ਟਰੈਵਲ ਕੰਪਨੀਆਂ ਟਰੈਵਲ ਏਜੰਟ ਹਨ ਜਿਹੜੇ ਕਿ ਅੱਜ ਕੱਲ੍ਹ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਵਿਦੇਸ਼ਾਂ ਦੇ ਵਿੱਚ ਭੇਜ ਰਹੇ ਹਨ ਪ੍ਰੰਤੂ ਬਹੁਤ ਸਾਰੀਆਂ ਕੰਪਨੀਆਂ ਐਸੀਆਂ ਹਨ ਜਿਨ੍ਹਾਂ ਦਾ ਸਿਸਟਮ ਜਿਨ੍ਹਾਂ ਦਾ ਤਰੀਕਾ ਬਹੁਤ ਵਧੀਆ ਹੈ ਪ੍ਰੰਤੂ ਬਹੁਤ ਸਾਰੀਆਂ ਕੰਪਨੀਆਂ ਹਨ ਕਿ ਜਿਹੜੇ ਜਿਨ੍ਹਾਂ ਦੀ ਸਰਵਿਸ ਬਹੁਤ ਘਟੀਆ ਹੈ ਜਿਹਦੇ ਨਾਲ ਮੁੰਡੇ ਕੁੜੀਆਂ ਖੱਜਲ ਹੋ ਰਹੇ ਹਨ